ਪਕਾਉਣ ਲਈ ਮੇਰੀ ਸਭ ਤੋਂ ਪਸੰਦੀਦਾ ਕਿਸਮ ਦਾ ਪਕਵਾਨ ਪਾਸਤਾ ਹੈਗਾ ਇਹ ਇੱਕ ਪੁਰਾਣੀ ਇਟਾਲੀਅਨ ਇ ਇਟਲੀ ਦੀ ਡਿਸ਼ ਹੈਗੀ ਜਿਹੜੀ ਕਾਫੀ ਦੇਰ ਤੋਂ ਚਲਦੀ ਪਈ ਹੈ ਅਤੇ ਇਹਦੀ ਕਾਫੀ ਸਾਰੇ ਰੂਪ ਹੈਗੇ ਪਕਾਉਣ ਵਾਸਤੇ ਅਤੇ ਮੈਨੂੰ ਇਹ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਖਾਣ ਵਿੱਚ ਸੁੰਘਣ ਵਿੱਚ ਅਤੇ ਦਿਖਾਉਣ ਵਿੱਚ ਵੀ ਇਹਦੀ ਪੇਸ਼ ਕਰਨ ਦੀ ਕਲਾ ਬਹੁਤ ਹੀ ਵਧੀਆ ਹੈ ਹੁੰਦੀ ਹੈ ਇਹਦੇ ਉੱਤੇ ਇਹਦੇ ਵਿੱਚ ਕੋਈ ਵੀ ਸਬਜ਼ੀ ਵਗੈਰਾ ਪਾ ਕੇ ਬਣਾ ਸਕਦੇ ਹੋ ਕਿਸੇ ਬੱਚੇ ਨੂੰ ਖਿਲਾਉਣਾ ਹੋ ਉਸ ਵਾਸਤੇ ਵੀ ਬੜੀ ਵਧੀਆ ਚੀਜ਼ ਹੈਗੀ ਅਤੇ ਇੱਕ ਸਕੂਨ ਜਿਹਾ ਆਉਂਦਾ ਇਹਨੂੰ ਖਾ ਕੇ ਕਿ ਇਕ ਅਲੱਗ ਜਿਹੀ ਨਾ ਚੀਜ਼ ਚੀਜ਼ਾਂ ਦਿਮਾਗ 'ਚ ਆਉਂਦੀਆਂ ਅਤੇ ਇਹ ਸਕੂਨ ਦਿਲਾਉਂਦਾ ਖਾ ਕੇ ਇਹਨੂੰ ਅਤੇ ਪਕਾਉਣ ਵੇਲੇ ਵੀ ਕਾਫੀ ਵਧੀਆ ਲੱਗਦਾ ਅਤੇ ਕਾਫੀ ਅਸਾਨ ਆ ਇਹਨੂੰ ਬਣਾਉਣਾ ਮਿੰਟਾਂ ਵਿੱਚ ਵੀ ਬਣ ਜਾਂਦੀ ਹੈ ਕੁਝ ਜ਼ਿਆਦਾ ਦੇਰ ਲਾ ਦਿਉ ਹੋਰ ਵਧੀਆ ਬਣ ਜਾਂਦੀ ਹੈ ਅਤੇ ਇਹਨੂੰ ਖਾਂਦੇ ਟਾਈਂ ਇਹਨੂੰ ਖਾਣ ਤੋਂ ਜ਼ਿਆਦਾ ਖਿਲਾਉਣ ਵਾਸਤੇ ਜ਼ਿਆਦਾ ਵਧੀਆ ਲੱਗਦਾ ਵਾ ਕ ਲੋਕਾਂ ਦੇ ਚਿਹਰੇ ਵੇਖੇ ਖੁਸ਼ ਹੁੰਦੇ ਕਿ ਕਿੰਨਾ ਵਧੀਆ ਖਾਣਾ ਬਣਿਆ